ਇਸ ਕਰਕੇ ਪ੍ਰਸਿੱਧ ਹੈ ਕਿਉਂਕਿ ਇਹ ਲੋਕਾਂ ਦੇ ਦੁਆਰਾ ਹੀ ਨਿਰਮਾਣ ਕੀਤਾ ਗਿਆ ਹੈ ਤੇ ਸਾਡੇ ਸਮਾਜ ਨੂੰ ਦਰਸ਼ਾਉਂਦਾ ਹੈ ਤੇ ਮੈਨੂੰ ਜੀ ਗੁਰਮੀਤ ਬਾਵਾ ਜੀ ਦਾ ਬਹੁਤ ਸੋਹਣਾ ਲੱਗਦਾ ਬਾਵਾ ਜਿਹਦੇ ਲਾਈਨ ਹਨ ਬੋਲ ਮਿੱਟੀ ਦਿਆ ਪਾਵੇ ਆਵੇ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਵੇ ਮੇਰਾ ਸੋਹਣਾ ਮਾਹੀ ਆਜਾ ਹੋ ਧੰਨਵਾਦ